ਜਿਵੇਂ ਕਿ ਘੁੰਮਣਾ ਫਿਰਨਾ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵੱਡੀ ਮਹੱਤਤਾ ਹੈ ਘੁੰਮਣ ਫਿਰਨ ਵਿੱਚ ਬਾਕੀ ਜਿਵੇਂ ਕਿ ਅਸੀਂ ਮੈਨੂੰ ਆਪਣੇ ਯਾਰ ਦੋਸਤਾਂ ਨਾਲ ਇਹ ਘੁੰਮਣਾ ਫਿਰਨਾ ਮੈਨੂੰ ਬਹੁਤ ਵਧੀਆ ਲੱਗਦਾ ਬਾਕੀ ਇਹ ਉਹਨਾਂ ਨਾਲ ਟੈਮ ਸਪੈਂਡ ਕਰਨਾ ਬਹੁਤ ਵਧੀਆ ਲੱਗਦਾ ਕਿਤੇ ਐਡਵੈਂਚਰ ਟਰੈਕਿੰਗ ਕਰਨੀ ਮੈਨੂੰ ਬਹੁਤ ਵਧੀਆ ਲੱਗਦੀ ਅਸੀਂ ਕੋਈ ਵੀ ਆਪਣੇ ਘਰ ਤੋਂ ਇਹ ਟੈਮ ਦੀ ਐਡਜਸਟਮੈਂਟ ਆਪਣੇ ਘਰ ਤੋਂ ਸ਼ੁਰੂ ਕਰਦੇ ਜਿੱਦਾਂ ਸਾਨੂੰ ਇਹ ਜਿਵੇਂ ਕਿ ਸਾਨੂੰ ਕਿਤੇ ਸੰਡੇ ਛੁੱਟੀ ਹੁੰਦੀ ਜਿਵੇਂ ਕਿ ਕੋਈ ਹੋ ਛੁੱਟੀ ਹੁੰਦੀ ਤਾਂ ਅਸੀਂ ਉਸ ਹਿਸਾਬ ਨਾਲ ਅਸੀਂ ਇਹ ਕਿਤੇ ਇਹ ਦੂਰ ਜਾਣਾ ਹੋਵੇ ਆਪਣੇ ਪੰਜਾਹ ਸੱਠ ਕਿਲੋਮੀਟਰ ਦੇ ਏਰੀਏ ਵਿੱਚ ਘੁੰਮ ਕੇ ਇੱਦਾਂ ਹੁੰਦਾ ਜਿਵੇਂ ਸ਼ਾ ਇਹ ਸੁ ਸੁਬਹ ਸਵੇਰ ਤੋਂ ਜਾ ਕੇ ਆਪਾਂ ਸ਼ਾਮ ਨੂੰ ਘਰ ਆ ਜਾਈਏ ਤਾਂ ਸਾਨੂੰ ਇਹ ਘਰਦਿਆਂ ਦੇ ਬਚਨਬੰਧਤਾਵਾਂ ਵੀ ਇਹ ਦੇਖਣੀਆਂ ਪ ਪੈਂਦੀਆਂ ਬਾਕੀ ਉਸ ਹਿਸਾਬ ਨਾਲ ਅਸੀਂ ਕਿਤੇ ਵੀ ਦੇ ਦੂਰ ਨੇੜੇ ਜਾ ਕੇ ਅਸੀਂ ਆਪਾਂ ਆ ਸਕਦੇ ਟੈਮ ਨਾਲ ਇਹ ਬਾਕੀ ਆਪਾਂ ਮੈਨੂੰ ਇਹ ਇਹ ਜਾ ਕੇ ਆਪਣੇ ਦੂਰ ਯਾਰਾਂ ਦੋਸਤਾਂ ਨਾਲ ਇਹ ਟੈਮ ਸਪੈਂਡ ਕਰਨ ਦਾ ਮੈਨੂੰ ਬਹੁਤ ਵਧੀਆ ਲੱਗਦਾ